ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਹੈ ਜੋ ਕਿ ਮੈਂ ਆਪਣੀ ਮਾਂ ਤੋਂ ਸਿੱਖਿਆ ਸੀ ਮੇਰੀ ਮਾਂ ਨੇ ਮੈਨੂੰ ਦਾਲ ਸਭ ਤੋਂ ਪਹਿਲਾਂ ਦਾਲ ਬਣਾਉਣੀ ਸਿਖਾਈ ਦਾਲ ਵਿੱਚ ਦਾਲ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਚੁੱਲੇ ਵਿੱਚ ਅੱਗ ਬਾਲ ਕੇ ਪਤੀਲੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਦਾਲ ਦਾਲ ਪਾਈ ਦਾਲ ਧੋ ਕੇ ਉਹਦੇ ਵਿੱਚ ਦਾਲ ਪਾ ਤੀ ਨਮਕ ਹਲਦੀ ਪਾ ਕੇ ਉਸਨੂੰ ਰਿੱਝਣ ਦਿੱਤਾ ਫਿਰ ਉਸ ਦਾ ਸਾਰਾ ਫਿਰ ਲਸਣ ਨੂੰ ਛਿਲ ਕੇ ਇੱਕ ਪਾਸੇ ਰੱਖ ਲਿਆ ਪਿਆਜ਼ ਨੂੰ ਚੀਰ ਲਿਆ ਫਿਰ ਲਸਣ ਅਤੇ ਅਦਰਕ ਨੂੰ ਪਹਿਲਾਂ ਤੇਲ ਧਰਿਆ ਫਿਰ ਲਸਣ ਅਤੇ ਅਦਰਕ ਨੂੰ ਪਹਿਲਾਂ ਤੜਕਾ ਭੁੰਨਿਆ ਜੀਰਾ ਭੁੰਨਿਆ ਫਿਰ ਲਸਣ ਅਦਰਕ ਨੂੰ ਪਾ ਕੇ ਭੁੰਨ ਲਿਆ ਉਸ ਤੋਂ ਬਾਅਦ ਪਿਆਜ਼ ਪਾ ਲਿਆ ਪਿਆਜ਼ ਪਾ ਕੇ ਪਿਆਜ਼ ਨੂੰ ਭੁੰਨਣ ਤੋਂ ਬਾਅਦ ਉਹਦੇ ਵਿੱਚ ਹਰੀਆਂ ਮਿਰਚਾਂ ਪਾ ਕੇ ਇੱਕ ਸਾਈਡ ਤੜਕਾ ਇੱਕ ਸਾਈਡ 'ਤੇ ਰੱਖ ਪ ਭੁੰਨ ਕੇ ਇੱਕ ਸਾਈਡ 'ਤੇ ਰੱਖ ਲਿਆ ਜਦੋਂ ਦਾਲ ਰਿੱਝ ਗਈ ਤਾਂ ਤੜਕੇ ਨੂੰ ਦਾਲ ਵਿੱਚ ਪਾ ਦਿੱਤਾ ਜੋ ਕਿ ਦਾਲ ਮੈਂ ਪਹਿਲੀ ਵਾਰ ਬਣਾਈ ਬਹੁਤ ਵਧੀਆ ਬਣੀ ਉਸ ਤੋਂ ਬਾਅਦ ਮੈਂ ਆਪਣੀ ਨੂੰਹ ਨੂੰ ਨੂੰਹ ਨੂੰ ਨੂੰਹ ਨੂੰ ਵੀ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਸੀ ਫਿਰ ਉਸਨੇ ਮੈਨੂੰ ਕਿਹਾ ਕੀ ਮੰਮੀ ਮੈਨੂੰ ਕੜੀ ਬਣਾਉਣੀ ਨਹੀਂ ਆਉਂਦੀ ਫਿਰ ਮੈਂ ਉਸਨੂੰ ਕੜੀ ਬਣਾਉਣੀ ਸਿਖਾਈ ਕੜੀ ਬਣਾਏ ਕੜੀ ਬਣਾਉਣੀ ਪਹਿਲੀ ਵਾਰ ਘੜੀ ਬਣਾਉਣੀ ਸਿਖਾਈ ਕੜੀ ਉਸਨੂੰ ਕੜੀ ਉਸਨੇ ਬਹੁਤ ਸਵਾਦ ਬਣਾਈ ਜੋ ਕਿ ਉਸ ਨੇ ਸਾਰਿਆਂ ਨੇ ਬਹੁਤ ਪਸੰਦ ਕੀਤੀ ਇਸ ਲਈ ਉਸ ਨੂੰ ਵੀ ਉਸਨੇ ਵੀ ਕਾਫੀ ਹੋਰ ਵੀ ਕਾਫੀ ਚੀਜ਼ਾਂ ਨੇ ਜੋ ਮੇਰੇ ਤੋਂ ਸਿੱਖ ਲਈਆਂ ਨੇ ਹੁਣ ਕੱਲ੍ਹ ਹੀ ਮੇਰੀ ਪੋਤਰੀ ਕਹਿੰਦੇ ਕਿ ਦਾਦੀ ਮੰਮਾ ਮੈਨੂੰ ਕੁਛ ਬਣਾਉਣਾ ਸਿਖਾਓ ਇਸ ਲਈ ਮੈਂ ਉਸ ਨੂੰ ਆਲੂ ਮਟਰਾਂ ਦੀ ਸਬਜ਼ੀ ਬਣਾਉਣੀ ਸਿਖਾਈ ਜੋ ਉਸਨੇ ਪਹਿਲੀ ਵਾਰ ਬਣਾਈ ਮੈਂ ਉਹਨੂੰ ਦੱਸੀ ਗਈ ਅਤੇ ਉਸਨੇ ਸਬਜ਼ੀ ਬਣਾਈ ਜੋ ਕਿ ਬਹੁਤ ਸਵਾਦ ਬਣੀ ਸਾਰਿਆਂ ਨੇ ਬਹੁਤ ਹੀ ਪਸੰਦ ਕੀਤੀ ਇਸ ਲਈ ਸਾਨੂੰ ਖਾਣਾ ਹੀ ਸਭ ਤੋਂ ਸਭ ਤੋਂ ਜ਼ਿਆਦਾ ਸੌਖਾ ਸਾਰੇ ਹੀ ਖਾਣਾ ਵਧੀਆ ਬਣਾ ਲੈਂਦੇ ਹਨ ਮੇਰੀ ਨੂੰਹ ਵੀ ਖਾਣਾ ਬਹੁਤ ਸਵਾਦ ਬਣਾਉਂਦੀ ਹੈ ਹੁਣ ਮੈਂ ਆਪਣੀ ਪੋਤਰੀ ਨੂੰ ਖਾਣਾ ਬਣਾਉਣ ਦੀ ਜਾਚ ਸਿਖਾਉਣ ਡਈ ਸਿਖਾ ਰਹੀ ਹਾਂ ਇਹ ਸਾਰਿਆਂ ਨੂੰ ਹੀ ਖਾਣਾ ਬਣਾਉਣ ਦੀ ਜਾਚ ਹੋਣੀ ਚਾਹੀਦੀ ਹੈ ਚਾਹੇ ਬੱਚਾ ਪੜ੍ਹਿਆ ਲਿਖਿਆ ਹੋਏ ਪਰ ਖਾਣਾ ਬਣਾਉਣਾ ਜ਼ਰੂਰ ਆਉਣਾ ਚਾਹੀਦਾ ਹੈ ਸਾਨੂੰ ਖਾਣਾ ਹੀ ਖਾਣਾ ਜ਼ਿੰਦਗੀ ਵਿੱਚ ਖਾਣਾ ਸਭ ਤੋਂ ਬਣਾਉਣਾ ਘਰ ਦਾ ਕੰਮ ਆਉਣਾ ਸਭ ਤੋਂ ਜ਼ਰੂਰੀ ਹੈ